ਵੈਸੇ ਤਾਂ ਮੈਨੂੰ ਸਾਰੀਆਂ ਭਾਸ਼ਾਵਾਂ ਹੀ ਦਿਲਚਸਪ ਅਤੇ ਸਧਾਰਨ ਲੱਗਦੀਆਂ ਹਨ ਬਟ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਮੈਨੂੰ ਬਹੁਤ ਹੀ ਜ਼ਿਆਦਾ ਦਿਲਚਸਪ ਲੱਗਦੀ ਹੈ ਕਿਉਂਕਿ ਇਹ ਬਹੁਤ ਹੀ ਮਿੱਠ ਬੋਲੜੀ ਭਾਸ਼ਾ ਆ ਅਤੇ ਇਹਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਸ਼ਬਦ ਅਤੇ ਵਾਕਾਂਸ਼ ਹਨ ਜੋ ਦਿਲਚਸਪ ਹਨ ਅਤੇ ਜਿਨ੍ਹਾਂ ਦਾ ਮਤਲਬ ਬਹੁਤ ਹੀ ਗੂੜ੍ਹਾ ਨਿਕਲਦਾ ਹੈ ਕੁਝ ਕੁ ਸ਼ਬਦ ਜਿਵੇਂ ਡੰਗਾ ਦਰਬਾਰ ਅੰਮ੍ਰਿਤ ਫਿੱਟੇ ਮੂੰਹ ਇਹ ਬਹੁਤ ਹੀ ਦਿਲਚਸਪ ਸ਼ਬਦ ਹਨ ਅਤੇ ਕੁਝ ਕੁ ਵਾਕਾਂਸ਼ ਜਿਵੇਂ ਇੱਕ ਮਿਆਨ ਦੋ ਤਲਵਾਰਾਂ ਸੱਤਵੇਂ ਅਸਮਾਨ 'ਤੇ ਉੱਡਣਾ ਦੋਹੀਂ ਹੱਥੀਂ ਲੱਡੂ ਹੋਣਾ ਇਹ ਸਾਰੇ ਹੀ ਬਹੁਤ ਹੀ ਦਿਲਚਸਪ ਅਤੇ ਧਿਆਨ ਦੇਣ ਯੋਗ ਸ਼ਬਦ ਅਤੇ ਵਾਕਾਂਸ਼ ਹਨ